ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਬੱਸ ਬੜੀਆ ਜੀ ਤੁਸੀਂ ਦੱਸੋ ਵੀਰੇ ਇਸ ਟਾਈਮ ਤਾਂ ਕਰੰਟ ਸੀਜ਼ਨ ਅਤੇ ਆ ਗਿਆ ਤਰਬੂਜ਼ ਆ ਗਿਆ ਵਾਟਰਮੈਲਨ ਆ ਗਿਆ ਅਤੇ ਮੈਂਗੋ ਆ ਗਏ ਅਤੇ ਹੋਰ ਵੀ ਅਤੇ ਐੱਪਲ ਵੀ ਮਿਲ ਜਾਣਗੇ ਆਪਣੇ ਲਵੇ ਹਾਂਜੀ ਬੋਲੀ ਹਾਂ

ਨਹੀਂ ਜੀ ਉਹ ਵੀਰੇ ਬਿਲਕੁਲ ਠੀਕ ਰਹਿਣਗੇ ਜੀ ਕੋਈ ਕੰਪਲੇਂਟ ਆਲੀ ਗੱਲ ਨਹੀਂ ਅਸੀਂ ਡੇਲੀ ਦੀ ਸੇਲ ਆ ਸਾਡੀ ਅਤੇ ਮਤਲਬ ਤੁਸੀਂ ਟੈਂਨ ਅ ਟੈਂਨਸ਼ਨ ਨਾ ਲਓ ਜੀ ਅਸੀਂ ਆਪਣੇ ਕੰਨੀ ਪੂਰੇ ਫਰੈੱਸ਼ ਟਾਈਮ 'ਤੇ ਵਧੀਆ ਚੀਜ਼ ਦਿੰਦੇ ਹਾਂ ਸਾਡਾ ਨਾਮ ਚੱਲਦਾ ਜੀ ਸਾਡੀ ਸ਼ੌਪ ਦਾ ਵਧੀਆ ਫਰੂਟ ਇੱਧਰੋਂ ਹੀ ਮਿਲਦਾ

ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਟੈਂਨਸ਼ਨ ਨਾ ਲਓ ਜੀ ਟੈਂਨਸ਼ਨ ਨਾ ਲਓ ਤੁਹਾਨੂੰ ਕੋਈ ਕੰਪਲੇਂਟ ਨਹੀਂ ਆਉਣ ਦਿੰਦੇ ਸਾਡੀ ਜਿੰਮੇਵਾਰੀ ਆ ਹਾਂਜੀ ਡਰੈਗਨ ਫਰੂਟ ਮਿਲ ਜਾਊ ਦੱਸੋ ਕਿ ਕਿੰਨਾ ਚਾਹੀਦਾ ਦੇਖੋ ਜੀ ਰੇਟ ਤਾਂ ਇਹਦਾ ਸੌ ਸੱਤਰ ਤੋਂ ਅੱਸੀ ਰੁਪਏ ਪਰ ਪੀਸ ਚੱਲਦਾ ਅਗਰ ਤੁਸੀਂ ਕਰੇਟ ਲੱਗਾ ਕੇ ਚੱਲੋ ਵੀਹ ਪੀਸਾਂ ਦਾ ਇੱਕ ਕਰੇਟ ਹੁੰਦਾ ਹੈ ਸੌ ਤੁਸੀਂ ਲਓ ਮੈਂ ਤੁਹਾਨੂੰ ਪੰਜਾਹ ਰੁਪਏ ਨੂੰ ਦੇ ਦਊਂਗਾ ਪੰਜਾਹ ਨੂੰ ਤੁਸੀਂ ਕਰ ਲਓ ਵੀਹ ਨਾਲ ਮਲਟੀਪਲਾਏ ਇੱਕ ਹਜ਼ਾਰ ਦਾ ਇੱਕ ਕਰੇਟ ਦਊਂਗਾ ਜੀ ਮੈਂ ਤੁਹਾਨੂੰ ਹੁਣ ਕਰੇਟ ਕਿੰਨੇ ਚਾਹੀਦੇ ਨੇ ਕਰੇਟ ਕਿੰਨੇ ਚਾਹੀਦੇ ਨੇ ਪੰਜ ਕੁ ਕਰੇਟ ਚੜ੍ਹਾਉਣੇ ਐ ਕੋਈ ਗੱਲ ਨਹੀਂ ਜੀ ਚੜ੍ਹਾ ਦਾਂਗੇ ਜੀ ਹੋਰ ਦੱਸੋ ਹੋਰ ਕੋਈ ਫਰੂਟ ਚੜ੍ਹਾਉਣਾ ਹੋਵੇ ਹਾਂ ਆਹਾ ਅੰਬ ਅੰਬ ਥੋੜ੍ਹਾ ਕੌਸਟਲੀ ਮਿਲੇਗਾ ਪਰ ਮਿਲ ਜਾਏਗਾ ਕਿਉਂਕਿ ਹੁਣ ਅੰਬ ਦਾ ਥੋੜ੍ਹਾ ਐਡਵਾਂਸ 'ਚ ਆ ਗਿਆ ਨਾ ਅੰਬ ਥੋੜ੍ਹਾ ਤੁਹਾਨੂੰ ਕੌਸਟ ਮਿਲੇਗਾ ਜਿਵੇਂ ਮਾਰਕੀਟ 'ਚ ਤੁਹਾਨੂੰ ਚੱਲ ਡੇਢ ਸੌ ਰੁਪਏ ਕਿਲੋ ਮੈਂ ਤੁਹਾਨੂੰ ਸੌ ਰੁਪਏ ਕਿਲੋ ਦੇ ਦੇਵਾਂਗਾ ਤੁਹਾਨੂੰ ਕਰੇਟ ਕਿੰਨੇ ਚਾਹੀਦੇ ਨੇ ਦੋ ਚੜਾਣੇ ਐ ਇੱਕ ਕਰੇਟ ਨਾਲ ਲਾ ਕੇ ਚੱਲੋ ਵੀਹ ਵੀਹ ਪੀਸ ਹੁੰਦੇ ਨੇ ਦੋ ਹਜ਼ਾਰ ਹਾਂ ਹਾਂ ਹਾਂ ਹਾਂ ਤੁਹਾਨੂੰ ਵਿਦੇਸ਼ੀ ਵੀ ਮਿਲ ਜਾਊਗਾ ਦੇਸੀ ਵੀ ਮਿਲ ਜਾਊਗਾ ਦੱਸੋ ਕਿਹੜਾ ਲੈਣਾ ਵਧੀਆ ਮੇਰੇ ਹਿਸਾਬ ਨਾਲ ਤੁਸੀਂ ਨਾ ਵਿਦੇਸ਼ੀ ਲਓ ਕਿਉਂਕਿ ਉਹ ਕਟ ਕੱਟ ਕੇ ਖਾਣ ਵਾਲਾ ਨਾ ਕਿ ਚੂਸਣ ਲੱਗ ਜਾਈਏ ਜਿਵੇਂ ਕਹਿੰਦੇ ਨੇ ਨਾ ਸਾਨੂੰ ਚੂਸੇ ਚੂਸਣ ਵਾਲਾ ਅੰਬ ਚਾਹੀਦਾ ਉਹ ਨਹੀਂ ਹੈ ਉਹ ਚੀਜ਼ ਨਹੀਂ ਹੁੰਦੀ ਉਹ ਉਹ ਹੁੰਦੀ ਹੈ ਖਾਣ ਵਾਲਾ ਮਤਲਬ ਕੱਟ ਕੇ ਖਾ ਲਓ ਜਿਵੇਂ ਕੋਈ ਬਾਹਰਲੀ ਵਧੀਆ ਕੁਆਲਟੀ ਦਾ ਅੰਬ ਜਿਹਨੂੰ ਕਹਿੰਦੇ ਆ ਆਪਾਂ ਜਿਹੜਾ ਚੂਸਣ ਵਾਲਾ ਹੈ ਚੂਸਣ ਵਾਲਾ ਹੈ ਉਹ ਤਾਂ ਤੁਹਾਨੂੰ ਮੈਂ ਬਹੋ ਦੇ ਦਊਂਗਾ ਸੱਤਰ ਰੁਪਏ ਨੂੰ ਰੇਟ ਨੂੰ ਕਿੱਲੋ ਵਨ ਪੀਸ ਹਾਂਜੀ ਹੋਰ

ਓਕੇ ਜੀ ਕੋਈ ਗੱਲ ਨਹੀਂ ਜੀ ਤੁਸੀਂ ਮੈਨੂੰ ਥੋੜ੍ਹੀ ਜਿਹੇ ਉਹ ਐਡਵਾਂਸ ਕਰਦੋ ਮੈਂ ਤਾਂ ਕਿ ਤੁਹਾਡੇ ਕਰੇਟ ਤੁਹਾਡੇ ਮੰਗਾ ਕੇ ਮੈਂ ਰੱਖਾਂ ਬੁੱਕ ਕਰਕੇ

ਬੱਸ ਠੀਕ ਹੈ ਜੀ ਡਿਲੀਵਰੀ ਰੇਟ ਰੇਟ ਵੀ ਉਦੋਂ ਹੀ ਕਰ ਦੇਖ ਲਾਂਗੇ ਆਪਾਂ ਤੁਸੀਂ ਜਦੋਂ ਆਉਗੇ ਇੱਕ ਵਾਰ ਕੇ ਓਕੇ ਜੀ